ਯੋਗਾ ਇਕੱਲੀ ਕਸਰਤ ਨਹੀਂ ਇਹਦੇ ਨਾਲ ਹੋਰ ਵੀ ਬਹੁਤ ਫਾਇਦੇ ਹੁੰਦੇ ਆ ਇਹਦੇ ਨਾਲ ਸਰੀਰ ਵਧੀਆ ਰਹਿੰਦਾ ਹੈਗਾ ਫਿਟ ਰਹਿੰਦਾ ਹੈਗਾ ਇਹਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਯੋਗਾ ਕਰਨ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਲੀਵਰ ਦੀ ਸਮੱਸਿਆ ਸਹੀ ਜੇ ਕਿਸੇ ਨੂੰ ਕੋਈ ਬਿਮਾਰੀ ਆ ਥੈਰਡ ਵਗੈਰਾ ਜਾਂ ਉਹ ਕੋਈ ਵੀ ਮਤਲਬ ਲੇਡੀ ਹੈ ਲੇਡੀ ਨੂੰ ਲੇਡੀ ਜ਼ਿਆਦਾ ਪ੍ਰੋਬਲਮ ਹੁੰਦੀਆਂ ਇਹਦੇ ਨਾਲ ਕਾਫੀ ਹੱਦ ਤੱਕ ਉਹ ਠੀਕ ਹੁੰਦੀਆਂ ਹੈਗੀਆਂ ਜਾਂ ਮਤਲਬ ਯੋਗਾ ਕਰਨ ਨਾਲ ਕੀ ਹੁੰਦਾ ਹੈਗਾ

ਅਤੇ ਯੋਗਾ ਕਰ ਸਵੇਰੇ ਉੱਠ ਕੇ ਮੋਰਨਿੰਗ ਦੇ ਵਿੱਚ ਸਵੇਰੇ ਸਵੇਰੇ ਯੋਗਾ ਕਰਨ ਨਾਲ ਸਰੀਰ ਕਾਫੀ ਬੰਦਾ ਖੁਸ਼ ਰਹਿੰਦਾ ਹੈਗਾ ਅਤੇ ਯੋਗਾ ਕਰਨ ਨਾਲ ਬਹੁਤ ਬਿਮਾਰੀਆਂ ਠੀਕ ਹੁੰਦੀਆਂ ਹੈਗੀਆਂ ਅਤੇ ਆਪਾਂ ਨੂੰ ਮੈਡੀਸਨ ਤੋਂ ਰਾਹਤ ਮਿਲਦੀ ਆ ਥਾਈਰਡ ਵਗੈਰਾ ਕੈਸਟਰੋਲ ਵਗੈਰਾ ਵਧਦਾ ਯੋਗਾ ਕਰਨ ਨਾਲ ਇਹ ਚੀਜ਼ਾਂ ਸਹੀ ਹੁੰਦੀਆਂ ਐਕਸਰਸਾਈਜ਼ ਕਰਨੀ ਜ਼ਰੂਰੀ ਹੈ